ਮੈਂ ਸਿਲਾਈ ਜਾਂ ਬੁਣਾਈ ਦੇ ਪ੍ਰੋਜੈਕਟਾਂ ਲਈ ਆਮ ਤੌਰ 'ਤੇ ਰੰਗ ਇੰਸਟਾਗ੍ਰਾਮ ਤੋਂ ਵੇਖਦੀ ਹਾਂ ਜਿੱਥੇ ਬੜੇ ਹੀ ਤਰੀਕਿਆਂ ਨਾਲ਼ ਵੱਖ ਵੱਖ ਰੰਗਾਂ ਨੂੰ ਆਪਸ ਵਿੱਚ ਜੋੜ ਕੇ ਵਧੀਆ ਮੇਲ ਬਣਾਏ ਜਾਂਦੇ ਹਨ ਉਹਨਾਂ ਰੰਗ ਪਾਇਲਟ ਦੀ ਚੋਣ ਕਰਨ ਲਈ ਸਕੈਚ ਵਾਲੇ ਰੰਗਾਂ ਨੂੰ ਕਾਪੀ ਉੱਪਰ ਚਲਾ ਕੇ ਉਹਨਾਂ ਦੀ ਵਧੀਆ ਮੈਚ ਬਣਾ ਸਕਦੇ ਹਾਂ ਜਿਵੇਂ ਕਿ ਵੇਖੀਏ ਗੁਲਾਬੀ ਦੇ ਨਾਲ਼ ਹਰੇ ਦਾ ਵਧੀਆ ਮੇਲ ਬਣਦਾ ਹੈ ਲਾਲ ਦੇ ਨਾਲ਼ ਪੀਲਾ ਬਹੁਤ ਖਿੜ ਖਿੜ ਕੇ ਪੈਂਦਾ ਹੈ ਮੇਰੇ ਮਨਪਸੰਦ ਦੇ ਰੰਗ ਚਿੱਟਾ ਗੁਲਾਬੀ ਹਰੇ ਹਨ